ਸਤਿ ਸ਼੍ਰੀ ਅਕਾਲ ਮੈਂ ਪ੍ਰੀਆ ਜੀ ਹਾਂ ਸਾਡੇ ਖੇਤਰ ਵਿੱਚ ਬਹੁਤ ਸਾਰੇ ਕਾਰੋਬਾਰ ਜਿਹੜੇ ਹੈ ਉਹ ਸ਼ੁਰੂ ਕੀਤੇ ਜਾ ਸਕਦੇ ਹਨ ਜਿਵੇਂ ਕਿ ਬੱਚੇ ਪੜ੍ਹੇ ਲਿਖੇ ਹਨ ਉਹ ਟਿਊਸ਼ਨ ਸੈਂਟਰ ਖੋਲ੍ਹ ਸਕਦੇ ਹਨ ਆਪਣੇ ਇੰਸਟੀਟਿਊਟ ਖੋਲ੍ਹ ਸਕਦੇ ਹਨ ਅਤੇ ਜੇਕਰ ਗੱਲ ਕੀਤੀ ਜਾਵੇ ਕੁਝ ਲੋਕ ਇੱਥੇ ਡੇਰੀ ਫਾਰਮ ਵੀ ਖੋਲ੍ਹ ਸਕਦੇ ਹਨ ਪਸ਼ੂ ਪਾਲਣ ਦਾ ਜਿਹੜਾ ਕੰਮ ਹੈ ਉਹ ਵੀ ਖੋਲ੍ਹ ਸਕਦੇ ਹਨ ਅਤੇ ਜਿਹੜੀਆਂ ਔਰਤਾਂ ਘਰ ਵਿੱਚ ਰਹਿ ਕੇ ਆਪਣਾ ਟਾਈਮ ਜਿਹੜਾ ਹੈ ਉਹ ਜਾਇਆ ਕਰਦੀਆਂ ਹਨ ਉਹ ਸਟੀਚਿੰਗ ਦਾ ਸਿੱਖ ਕੇ ਆਪਣੇ ਬੁਟੀਕ ਵਗੈਰਾ ਖੋਲ੍ਹ ਸਕਦੇ ਹਨ ਅਤੇ ਕੁਝ ਤੇ ਔਰਤਾਂ ਨੇ ਤਾਂ ਇੱਥੇ ਉਹ ਪਾਰਲਰ ਦਾ ਕੰਮ ਵੀ ਖੋਲ੍ਹਿਆ ਹੋਇਆ ਹੈ ਹੋਰ ਵੀ ਕਈ ਕੰਮ ਹਨ ਜਿਹੜੇ ਖੋਲ੍ਹੇ ਜਾ ਸਕਦੇ ਹਨ